ਮੈਨੂੰ ਗਾਣਾ ਪਸੰਦ ਸੀ ਇਸ ਲਈ ਮੈਂ ਇਸ 'ਚ ਬਹੁਤ ਚੁਣੌਤੀਆਂ ਵੀ ਆਈਆਂ ਜਦੋਂ ਮੈਂ ਆਪਣੇ ਸਕੂਲ ਵਿੱਚ ਪੜ੍ਹਦੀ ਹੁੰਦੀ ਸੀ ਤਾਂ ਮੈਨੇ ਗਾਉਣ ਦਾ ਆਪਣੇ ਫੇਅਰਵੈੱਲ 'ਤੇ ਫੈਸਲਾ ਕੀਤਾ ਕਿ ਮੈਂ ਗਾਊਂਗੀ ਤਾਂ ਸਭ ਤੋਂ ਪਹਿਲੀ ਮੁਸ਼ਕਿਲ ਮੈਨੂੰ ਆਈ ਕਿ ਮੈਨੇ ਗਾਣਾ ਸਿਲੈਕਟ ਕਰਨ 'ਚ ਵੀ ਹਾਂ ਕਿਹੜਾ ਗਾਇਆ ਜਾਵੇ ਹੈ ਨਾ ਸਕੂਲ ਦੇ ਹਿਸਾਬ ਨਾਲ ਆਪਾਂ ਉਸ ਟਾਇਮ 'ਤੇ ਜਿਹੜਾ ਵੀ ਠੀਕ ਲੱਗਦਾ ਹੈ ਨਾ ਉਹ 'ਤੇ ਕਿਹੜਾ ਗਾਇਆ ਜਾਵੇ ਜਦੋਂ ਉਸ ਤੋਂ ਬਾਅਦ ਜਦੋਂ ਮੈਂ ਗਾਣਾ ਸਿਲੈਕਟ ਕੀਤਾ ਫਿਰ ਮੈਨੇ ਉਹਦੀ ਕਾਫੀ ਟਾਇਮ ਕਿੰਨੇ ਹੀ ਦਿਨ ਨਾ ਰਿਹਸਲ ਕੀਤੀ ਰਿਹਸਲ ਕਰਨ ਤੋਂ ਬਾਅਦ ਜਦੋਂ ਮੈਂ ਤਿਆਰ ਹੋਈ ਗਾਣ ਲਈ ਉਹਦੀ ਫੇਅਰਵੈੱਲ ਦਾ ਦਿਨ ਆਇਆ ਮੇਰੀ ਪਰਫੋਰਮੈਂਸ ਸੀ ਜਦੋਂ ਉਦੋਂ ਮੈਂ ਸਟੇਜ ਉੱਤੇ ਖੜ੍ਹ ਗਈ ਥੋੜ੍ਹਾ ਜਾ ਡਰ ਤਾਂ ਲੱਗਣਾ ਹੀ ਸੀਗਾ ਹੈ ਨਾ ਕਿਉਂਕਿ ਮੈਂ ਪਹਿਲਾਂ ਕਦੇ ਵੀ ਗਾਇਆ ਨਹੀਂ ਸੀਗਾ ਇੰਨੀ ਕੁ ਵਾਰ ਇੱਕ ਜਾਂ ਦੋ ਵਾਰ ਗਾਇਆ ਹੋਣਾ ਇਸ ਲਈ ਮੈਨੂੰ ਬਹੁਤ ਹੀ ਇਹ ਔਖਾ ਲੱਗਿਆ ਗਾਣਾ ਸਭ ਤੋਂ ਪਹਿਲਾਂ ਜਦੋਂ ਮੈਂ ਸਟੇਜ 'ਤੇ ਗਈ ਪਹਿਲਾਂ ਤਾਂ ਬੜੀ ਤਾੜੀਆਂ ਦੀ ਆਵਾਜ਼ ਆਈ ਚਲੋ ਮੇਰਾ ਥੋੜ੍ਹਾ ਜਾ ਹੌਂਸਲਾ ਵਧਿਆ ਜਦੋਂ ਹੀ ਮੈਂ ਗਾਣਾ ਸਟਾਰਟ ਕੀਤਾ ਤਾਂ ਮੇਰਾ ਮਾਇਕ ਬੰਦ ਹੋ ਗਿਆ ਵਿੱਚ ਗਾਉਂਦੇ ਗਾਉਂਦੇੇ ਜਦੋਂ ਮਾਇਕ ਬੰਦ ਹੋਇਆ ਮੇਰਾ ਸਾਰਾ ਕੌਨਫੀਡੈਂਸ ਹੀ ਢਹਿ ਗਿਆ ਮੇਰੇ ਤਾਂ ਅੱਗੇ ਕੁਛ ਵੀ ਗਾਉਣ ਦਾ ਜੀਅ ਨਹੀਂ ਕੀਤਾ ਪਰ ਜਿਹੜੇ ਟੀਚਰ ਨੇ ਮੈਨੂੰ ਰਿਹਸਲ ਕਰਾਈ ਸੀ ਉਹਨਾਂ ਨੇ ਮੈਨੂੰ ਫਿਰ ਕਾਫੀ ਹੌਂਸਲਾ ਦਿੱਤਾ ਮੈਂ ਫਿਰ ਆਪਣਾ ਹੌਂਸਲਾ ਬਣਾਇਆ ਅਤੇ ਮੈਂ ਫਿਰ ਗਾਣਾ ਸ਼ੁਰੂ ਕਰ ਦਿੱਤਾ ਸਾਰਿਆਂ ਨੂੰ ਮੇਰਾ ਗਾਣਾ ਬਹੁਤ ਹੀ ਪਸੰਦ ਆਇਆ ਫਿਰ ਤਾੜੀਆਂ ਦੀ ਆਵਾਜ਼ ਨਾਲ ਮੇਰਾ ਹੌਂਸਲਾ ਉਵੇਂ ਹੀ ਰਿਹਾ ਅਤੇ ਮੈਂ ਇਸ ਚੁਣੌਤੀ ਨੂੰ ਇਵੇਂ ਕਰਕੇ ਪਾਰ ਵੀ ਕਰ ਲਿਆ